ਖੇਡਾਂ ਖੇਡਣ ਦੇ ਨਾਲ਼ ਸਾਡੇ ਸਰੀਰ ਅਤੇ ਮਨ ਨੂੰ ਤਾਜ਼ਗੀ ਪ੍ਰਾਪਤ ਹੁੰਦੀ ਹੈ ਤੰਦਰੁਸਤੀ ਪ੍ਰਾਪਤ ਹੁੰਦੀ ਹੈ ਹਰੇਕ ਖੇਡ ਦੇ ਵਿੱਚ ਅਲੱਗ ਅਲੱਗ ਅੰਗ ਕੰਮ ਕਰਦੇ ਹਨ ਅਤੇ ਅਲ ਅੰਗਾਂ ਦਾ ਸੰਤੁਲਨ ਸਾਡੇ ਮਨ ਦੇ ਨਾਲ਼ ਬਣਿਆ ਹੁੰਦਾ ਹੈ ਜੇਕਰ ਸਾਡਾ ਮਨ ਨਰੋਆ ਹੋਏਗਾ ਅਤੇ ਸਰੀਰ ਦੇ ਅੰਗ ਵੀ ਚੰਗੀ ਤਰੀਕੇ ਨਾਲ਼ ਕੰਮ ਕਰਨਗੇ ਇਸ ਲਈ ਖੇਡਾਂ ਖੇਡਣ ਸਾਰ ਕਸਰਤ ਕਰਨ ਸਾਰ ਜਾਂ ਅਭਿਆਸ ਕਰਨ ਦੇ ਦੌਰਾਨ ਸਾਡੇ ਮਨ ਵਿੱਚ ਚੰਗੇ ਵਿਚਾਰ ਆਉਂਦੇ ਹਨ ਅਤੇ ਖੇਡਾਂ ਵਿੱਚ ਰਣਨੀਤੀ ਘੜਨ ਲਈ ਲਾਹੇਵੰਦ ਹੁੰਦੇ ਹਨ